ਮੈਂ ਮੈਰਾਥੋਨ ਦੌੜ ਵਿੱਚ ਕਾਫੀ ਵਾਰੀ ਹਿੱਸਾ ਲਿਆ ਹੈ ਜਦੋਂ ਵੀ ਮੈਂ ਮੈਰਾਥੋਨ ਦੌੜ ਵਿੱਚ ਪਾਰਟੀਸਪੇਟ ਕਰਦਾ ਹਾਂ ਤਾਂ ਮੈਂ ਇੱਕ ਦੋ ਮਹੀਨੇ ਪਹਿਲਾਂ ਹੀ ਆਪਣੀ ਦੌੜ ਦੀ ਤਿਆਰੀ ਕਰਨ ਲੱਗ ਜਾਂਦਾ ਹਾਂ ਮੈਂ ਦੌੜ ਦੀ ਤਿਆਰੀ ਮੈਂ ਰੋਜ਼ ਸਵੇਰੇ ਛੇਤੀ ਉੱਠਦਾ ਹਾਂ ਅਤੇ ਆਪਣੀ ਦੌੜ ਲਈ ਤਿਆਰ ਹੋ ਡਰੈੱਸ ਪਾ ਕੇ ਤਿਆਰ ਹੋ ਜਾਂਦਾ ਹਾਂ ਅਤੇ ਮੈਂ ਆਪਣੀ ਦੌੜ ਮੈਂ ਦੋ ਤੋਂ ਚਾਰ ਕਿੱਲੋਮੀਟਰ ਰੋਜ਼ ਸਵੇਰੇ ਰਨਿੰਗ ਕਰਦਾ ਹਾਂ ਰਨਿੰਗ ਕਰਨ ਤੋਂ ਕਰਨ ਤੋਂ ਬਾਅਦ ਮੈਂ ਜੇ ਘਰ ਆਉਂਦਾ ਹਾਂ ਮੈਂ ਆਪਣੀ ਪੂਰੀ ਡਾਈਟ ਲੈਂਦਾ ਹਾਂ ਮੈਂ ਆਂਡੇ ਦੋ ਆਂਡੇ ਅਤੇ ਇੱਕ ਗਿਲਾਸ ਜੂਸ ਦਾ ਸੇਵਨ ਕਰਦਾ ਹਾਂ ਪੀਂਦਾ ਅਤੇ ਇਸ ਤਰ੍ਹਾਂ ਮੈਂ ਸ਼ਾਮ ਨੂੰ ਵੀ ਰਨਿੰਗ ਲਈ ਜਾਂਦਾ ਹਾਂ ਅਤੇ ਦੋ ਤੋਂ ਚਾਰ ਕਿੱਲੋਮੀਟਰ ਰਨਿੰਗ ਕਰਦਾ ਰਨਿੰਗ ਕਰਨ ਤੋਂ ਬਾਅਦ ਮੈਂ ਘਰ ਆ ਕੇ ਆਪਣੇ ਰੋਟੀ ਖਾਂਦਾ ਹਾਂ ਅਤੇ ਆਪਣੀ ਡਾਈਟ ਪੂਰੀ ਕਰਦਾ ਹਾਂ ਇਸੀ ਤਰ੍ਹਾਂ ਮੈਂ ਮੈਰਾਥੋਨ ਦੌੜ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਆਪਣੀ ਦੌੜ ਦੀ ਤੇ ਪ੍ਰੈਕਟਿਸ ਤਿਆਰੀ ਕਰਨ ਲੱਗ ਜਾਂਦਾ ਹਾਂ ਇਸ ਤਰ੍ਹਾਂ ਮੈਂ ਆਪਣੀ ਮੈਰਾਥੋਨ ਦੌੜ ਦੀ ਤਿਆਰੀ ਕਰਦਾ